ਹਾਂਜੀ ਹਾਂਜੀ ਇਹ ਬਗੀਚਾ ਜੀ ਦੇਖੋ ਸਾਰਿਆਂ ਨੂੰ ਬੜਾ ਪਿਆਰਾ ਹੁੰਦਾ ਹੈ ਜੀ ਸਵੇਰੇ ਉੱਠ ਕੇ ਪਹਿਲਾਂ ਸਭ ਤੋਂ ਕੰਮ ਪਹਿਲਾਂ ਇਹ ਹੀ ਕਰੀਦਾ ਜੀ ਬਗੀਚੇ ਦੇ ਵਿੱਚ ਬਹੁਤ ਹੀ ਰੰਗ ਬਿਰੰਗੇ ਸੋਹਣੇ ਫੁੱਲ ਲਾਏ ਦੇ ਜੀ ਜਿਹਦੇ 'ਚ ਵੱਡੀਆਂ ਕਿਆਰੀਆਂ ਵਿੱਚ ਸਬਜ਼ੀ ਬੀਜ਼ ਦੀ ਪਨੀਰੀ ਵੀ ਲਾਈ ਦੀ ਹੈ ਜੀ ਜਿਹਦੇ ਵਿੱਚੋਂ ਸਵੇਰੇ ਮੰਦਰ ਜਾਣ ਲਈ ਔਰ ਭਗਵਾਨ ਨੂੰ ਚਾੜ੍ਹਨ ਲਈ ਫੁੱਲ ਮਿਲ ਜਾਂਦੇ ਜੀ ਤਾਜ਼ੇ ਔਰ ਬਹੁਤ ਹੀ ਸਵੇਰੇ ਉੱਠ ਕੇ ਉੱਥੇ ਅਨੁਲੋਮ ਵਿਲੋਮ ਕਰੀਦਾ ਜੀ ਸੈਰ ਕਰੀ ਦੀ ਹੈ ਅਤੇ ਜਿਹਦੇ ਵਿੱਚੋਂ ਉਹਨਾਂ ਨੂੰ ਆਪਣੇ ਬੱਚਿਆਂ ਵੰਗਰ ਪਾਲੀ ਦਾ ਜਿਹਦੇ ਵਿੱਚੋਂ ਸਾਨੂੰ ਖਾਣ ਨੂੰ ਸਬਜ਼ੀਆਂ ਵੀ ਮਿਲ ਜਾਂਦੀਆਂ ਫੁੱਲ ਵੀ ਮਿਲ ਜਾਂਦੇ ਹੈ ਔਰ ਆਪਣਾ ਜਿਹੜੀ ਛੱਤ ਆ ਜੀ ਉਹ ਵੀ ਹਰੀ ਭਰੀ ਰਹਿੰਦੀ ਹੈ ਜਿਹਦੇ ਨਾਲ ਇੱਕ ਬਹੁਤ ਹੀ ਦਿਲ ਨੂੰ ਸਕੂਨ ਮਿਲਦਾ ਜੀ ਇੱਕ ਸ਼ਾਂਤੀ ਮਿਲਦੀ ਹੈ ਜਿਹਦੇ ਵਿੱਚੋਂ ਦੇਖਣ ਸੁਣਨ ਨੂੰ ਵੀ ਰੰਗ ਬਿਰੰਗੇ ਫੁੱਲਾਂ ਨੂੰ ਦੇਖ ਕੇ ਖੁਸ਼ੀ ਵੀ ਬੜੀ ਹੁੰਦੀ ਹੈ ਔਰ ਬਹੁਤ ਹੀ ਦਿਲ ਨੂੰ ਸਕੂਨ ਮਿਲਦਾ ਹੈ ਇਸ ਕਾਰਣ ਹਰ ਕਿਸੇ ਨੂੰ ਸਬਜ਼ੀਆਂ ਫੱਲ ਵਗੈਰਾ ਲਗਾਉਣੇ ਚਾਹੀਦੇ ਨੇ ਜਿਹਦੇ ਨਾਲ ਬਹੁਤ ਹੀ ਫ਼ਾਇਦੇ ਆ ਜੀ ਇਸ ਦੇ